ਪ੍ਰਾਪਤ ਕਰਨ ਲਈ ਬਣਾ ਰਹੀ ਹੈ ਅਤੇ ਹਰੇਕ ਬੇਤ ਉਹਨਾਂ ਨੂੰ ਸਿੱਖਿਆ ਅੱਜ ਕੱਲ੍ਹ ਦੀ ਸਰਕਾਰ ਬਹੁਤ ਹੀ ਬੇਤ ਮਹੱਤਵਪੂਰਨ ਅਤੇ ਵਧੀਆ ਬਣਾ ਚੁੱਕੀ ਹੈ ਅਤੇ ਇਹਨਾਂ ਦਾ ਉਪਾਅ ਉਪਾਏ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਣਾ ਬਣਾ ਰਹੀ ਹੈ